ਰਨਿੰਗ ਜਾਂ ਸੈਰ ਕਰਨਾ ਵੈਸੇ ਸਰੀਰ ਲਈ ਬਹੁਤ ਅੱਛਾ ਮੰਨਿਆ ਗਿਆ ਹੈ ਕਿਉਂਕਿ ਇਸ ਨਾਲ ਸਾਰਾ ਦਿਨ ਸਰੀਰ ਐਕਟਿਵ ਰਹਿੰਦਾ ਹੈ ਅਤੇ ਇਸ ਨਾਲ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਇਸ ਕਰਕੇ ਮੈਂ ਵੀ ਆਪਣੇ ਦੋਸਤਾਂ ਨਾਲ ਰਨਿੰਗ 'ਤੇ ਰੋਜ਼ ਰਨਿੰਗ 'ਤੇ ਜਾਂਦਾ ਹਾਂ ਕਿਉਂਕਿ ਕਈ ਕਿਉਂਕਿ ਕਈ ਮੇਰੇ ਦੋਸਤ ਆਰਮੀ ਦੀ ਵੀ ਤਿਆਰੀ ਕਰ ਰਹੇ ਹਨ ਅਤੇ ਕੋ ਕੋਈ ਕੋਈ ਪੁਲਿਸ ਦੀ ਤਿਆਰੀ ਕਰ ਰਿਹਾ ਤਾਂ ਜੋ ਉਹਨਾਂ ਉਹਨਾਂ ਲਈ ਅੱਗੇ ਚੱਲ ਕੇ ਰਨਿੰਗ ਵਾਲੇ ਦਿਨ ਸੌਖਾ ਹੋ ਸਕੇ ਇਸ ਕਰਕੇ ਮੈਂ ਵੀ ਉਹਨਾਂ ਨਾਲ ਜਾਂਦਾ ਹਾਂ ਸਾਡੇ ਸਾਡੇ ਸ਼ਹਿਰ ਵਿੱਚ ਇੱਕ ਸਰਕਾਰੀ ਕੋਲਜ ਹੈ ਅਤੇ ਸਰਕਾਰੀ ਕੋਲਜ ਵਿੱਚ ਇੱਕ ਬਹੁਤ ਹੀ ਸੋਹਣਾ ਸੋਹਣਾ ਸਟੇਡੀਅਮ ਬਣਿਆ ਹੋਇਆ ਹੈ ਜਿੱਥੇ ਕਿ ਰਨਿੰਗ ਵਾਸਤੇ ਅਲੱਗ ਟਰੈਕ ਹੈ ਖੇਡਾਂ ਵਾਸਤੇ ਵੀ ਅਲੱਗ ਜਗ੍ਹਾ ਬਣੀ ਹੋਈ ਹੈ ਜਿੱਥੇ ਕਿ ਬਹੁਤ ਸਾਰੇ ਆਸ ਪਾਸ ਦੇ ਬੱਚੇ ਖੇਡਣ ਖੇਡਾਂ ਖੇਡਣ ਆਉਂਦੇ ਹਨ ਅਤੇ ਕਈ ਰਨਿੰਗ ਵੀ ਕਰਦੇ ਹਨ ਅਤੇ ਕਈ ਆਮ ਜੋ ਲੋਕ ਹੈ ਉਹ ਸੈਰ ਵੀ ਕਰ ਰਹੇ ਹੁੰਦੇ ਹਨ ਸੈਰ ਸੈਰ ਵੀ ਕਰਨ ਲਈ ਸੈਰ ਵੀ ਕਰ ਰਹੇ ਹੁੰਦੇ ਹਨ ਜਿਸ ਨਾਲ ਕਿ ਉੱਥੇ ਪੂਰਾ ਵਧੀਆ ਮਾਹੌਲ ਬਣਿਆ ਬਣਿਆ ਹੋਇਆ ਹੈ ਬਣਿਆ ਹੋਇਆ ਕਈ ਵਾਰੀ ਅਸੀਂ ਨਹਿਰ ਦੇ ਕੰਢੇ ਵੀ ਚਲੇ ਜਾਂਦੇ ਹਾਂ ਸੈ ਨਹਿਰ ਦੇ ਕੰਢੇ ਵੀ ਚਲੇ ਜਾਂਦੇ ਹਾਂ